ਅੱਜ ਮੈਂ ਜ਼ਿੰਦਗੀ ਦੇ ਜਿਸ ਦੌਰ ਵਿੱਚੋਂ ਗੁਜ਼ਰ ਰਿਹਾ ਹਾਂ ਇਸ ਦੌਰਾਨ ਮੇਰੀ ਮੇਰੀ ਕਿਸੇ ਵੀ ਖੇਡ ਵਿੱਚ ਕੋਈ ਰੁਚੀ ਨਹੀਂ ਹਾਂ ਕੰਪਿਊਟਰ ਮੇਰੇ ਵਾਸਤੇ ਇੱਕ ਖੇਡ ਦੀ ਤਰ੍ਹਾਂ ਹੀ ਹੈ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਪਿਊਟਰ 'ਤੇ ਬੈਠ ਕੇ ਖੇਡ ਦੀ ਤਰ੍ਹਾਂ ਕੰਮ ਕਰ ਸਕਦਾ ਹਾਂ ਬਚਪਨ ਵਿੱਚ ਮੈਂ ਛੋਟੀਆਂ ਮੋਟੀਆਂ ਖੇਡਾਂ ਜ਼ਰੂਰ ਖੇਡਦਾ ਰਿਹਾ ਹਾਂ ਜਿਹਦੇ ਵਿੱਚ ਸਟਾਪੂ ਸਾਡੀ ਮ ਮਨਪਸੰਦ ਖੇਡ ਹੁੰਦੀ ਸੀ ਇਸ ਤੋਂ ਇਲਾਵਾ ਛੂਹਣ ਛੁਪਾਈ ਖੇਡਦੇ ਸੀ ਲੁਕਣ ਮੀਚੀ ਖੇਡਦੇ ਸੀ ਪਰ ਅੱਜ ਕੱਲ੍ਹ ਇਹ ਸਾਰੀਆਂ ਖੇਡਾਂ ਬੀਤੇ ਸਮੇਂ ਦੀ ਯਾਦ ਬਣ ਕੇ ਰਹਿ ਗਈਆਂ ਹਨ ਅੱਜ ਕੱਲ੍ਹ ਤਾਂ ਜ਼ਿਆਦਾ ਸਮਾਂ ਕੰਪਿਊਟਰ ਲੈਪਟਾਪ ਜਾਂ ਮੋਬਾਈਲ 'ਤੇ ਹੀ ਬੀਤਦਾ ਹੈ ਇਹੋ ਹੀ ਇੱਕ ਖੇਡ ਬਣ ਚੁੱਕੀ ਹੈ ਕਿਉਂਕਿ ਇਹ ਸਿਰਫ ਖੇਡ ਹੀ ਨਹੀਂ ਸਗੋਂ ਸਾਨੂੰ ਇਹਨਾਂ ਚੀਜ਼ਾਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ